ਉਂਝ ਤਾਂ ਬਹੁਤ ਸਾਹਿਤਕ ਪਾਤਰ ਹਨ ਪਰ ਮੈਨੂੰ ਸਭ ਤੋਂ ਵੱਧ ਪਰਮਿੰਦਰ ਟਿਵਾਣਾ ਪਸੰਦ ਹੈ ਜੋ ਕਿ ਇੱਕ ਵਧੀਆ ਕਲਾਕਾਰ ਹੈ ਉਹ ਬਹੁਤ ਹੀ ਚੰਗਾ ਇਨਸਾਨ ਹੈ ਅਤੇ ਗਰੀਬਾਂ ਦੀ ਬਹੁਤ ਮਦਦ ਕਰਦਾ ਹੈ ਬਜ਼ੁਰਗਾਂ ਨੂੰ ਬਹੁਤ ਸਤਿਕਾਰ ਦਿੰਦਾ ਹੈ ਉਸ ਪਾਸੋਂ ਮਨੁੱਖਤਾ ਦੀ ਭਲਾਈ ਲਈ ਕੰਮ ਕਰਨੇ ਦੇ ਢੰਗ ਸਿੱਖੇ ਹਨ ਉਹ ਲੋਕਾਂ ਵਿੱਚ ਵਿਚਰਦਾ ਹੋਇਆ ਕਿਸੇ ਵੀ ਮਨੁੱਖ ਨੂੰ ਨਜ਼ਰ ਅੰਦਾਜ਼ ਨਹੀਂ ਕਰਦਾ ਉਸ ਦੀ ਇੱਕ ਕਿਤਾਬ ਪੜ੍ਹੀ ਸੀ ਜਿਸ ਵਿੱਚ ਉਸ ਵੱਲੋਂ ਹਾਸੇ ਮਖੌਲ ਵਾਲੀਆਂ ਗੱਲਾਂ ਕੀਤੀਆਂ ਗਈਆਂ ਸਨ